ਪੰਜਾਬ ਸਰਕਾਰ ਦੀ ਬਹੁਤ ਵੱਡੀ ਭੂਮਿਕਾ ਆਪਣੇ ਦੇਸ਼ 'ਚੋਂ ਬਹੁਤ ਸਾਰਾ ਮਾਲ ਹੈ ਜੋ ਬਾਹਰ ਜਾਂਦਾ ਹੈ ਜਿਵੇਂ ਲੁਧਿਆਣੇ ਦਾ ਮਾਲ ਹੋ ਗਿਆ ਹੋਜਰੀ ਦਾ ਸਮਾਨ ਹੋ ਗਿਆ ਵਿਦੇਸ਼ਾਂ 'ਚ ਜਾਂਦਾ ਹੈ ਜਿਵੇਂ ਹੁਣ ਰੂਸ ਅਤੇ ਚੀਨ ਦੀ ਉਹ ਲੱਗੀ ਹੋਈ ਹੈ ਜੰਗ ਉੱਥੇ ਕਣਕ ਵਗੈਰਾ ਦਾ ਵੀ ਹੈ ਜਿਵੇਂ ਨਹੀਂ ਹੈ ਆਟਾ ਵਗੈਰਾ ਖਾਣ ਪੀਣ ਦਾ ਸਮਾਨ ਤਾਂ ਉਹ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਬਾਹਰ ਭੇਜਿਆ ਜਾਂਦਾ ਹੈ ਬਾਹਰ ਭੇਜਿਆ ਜਾਂਦਾ ਹੈ ਸਮਾਨ ਹੋਜਰੀ ਵਗੈਰਾ ਦਾ ਹੋ ਗਿਆ ਜਿਵੇਂ ਆ ਖਿਡਾਰੀ ਵਗੈਰਾ ਦਾ ਖਿਡਾਰੀ ਖੇਡਦੇ ਆ ਆਪਣੇ ਵੀ ਦੇਸ਼ ਤੋਂ ਬਾਹਰ ਜਿਵੇਂ ਖੇਡਦੇ ਆ ਉਹ ਵੀ ਮਾਲ ਆਪਾਂ ਵਿਦੇਸ਼ 'ਚ ਜਾਂਦਾ ਹੈ ਜਿਵੇਂ ਭੇਜਿਆ ਜਾਂਦਾ ਹੈ ਕਾਫ਼ੀ ਬਹੁਤ ਸਾਰੀ ਭੂਮਿਕਾ ਹੈ ਹੋਰ ਵੀ ਬਹੁਤ ਸਾਰਾ ਹੈ ਸਮਾਨ ਜੋ ਆਪਾਂ ਵਿਦੇਸ਼ ਨੂੰ ਦੇ ਕੇ ਵਿਦੇਸ਼ਾਂ 'ਚ ਭੇਜ ਕੇ ਆਪਾਂ ਪੈਸਾ ਕਮਾ ਸਕਦੇ ਹਾਂ ਮੈਂ ਖਿਡੌਣੇ ਵਗੈਰਾ ਹੋ ਗਏ ਇਲੈਕਟਰੋਨਿਕ ਸਮਾਨ ਹੋ ਗਿਆ ਇਲੈਕਟਰੋਨਿਕ ਸਮਾਨ ਹੋ ਗਿਆ ਉਹ ਸਮਾਨ ਵੀ ਆਪਾਂ ਭੇਜ ਕੇ ਭੇਜ ਕੇ ਉਹ ਪੈਸਾ ਕਮਾ ਸਕਦੇ ਹਾਂ ਬਹੁਤ ਹੈ ਭੂਮਿਕਾ ਸਰਕਾਰ ਜਿੰਨਾ ਵੀ ਹੋ ਸਕੇ ਆਪਾਂ ਭੂਮਿਕਾ ਨਿਭਾ ਸਕਦੇ ਹਾਂ ਸਰਕਾਰ ਆਪਣੀ ਬਹੁਤ ਮਦਦ ਕਰ ਸਕਦੀ ਆ ਜਿਵੇਂ ਆਪਾਂ ਲੋਕਾਂ ਨੂੰ ਦੇ ਕੇ ਆਪਾਂ ਖਿਡੌਣਾ ਵਗੈਰਾ ਹੋਰ ਸਮਾਨ ਜਿਵੇਂ ਟੋਆਏ ਵਗੈਰਾ ਹੋ ਗਏ ਚਕਲਾ ਵਗੈਰਾ ਚਿੱਠੀਆਂ ਵਗੈਰਾ ਇਹ ਸਾਰਾ ਵਿਦੇਸ਼ੀ ਕਣਕ ਵਗੈਰਾ ਵਗੈਰਾ ਹੋਰ ਕੋਈ ਸਮਾਨ ਹੋ ਗਿਆ ਭੇਜ ਸਕਦੇ ਹਾਂ ਆਪਾਂ ਵਿਦੇਸ਼ ਨੂੰ ਭੇਜ ਕੇ ਆਪਾਂ ਬਹੁਤ ਸਾਰਾ ਪੈਸਾ ਕਮਾ ਸਕਦੇ ਹਾਂ